ਵੈਸੇ ਤਾਂ ਮੈਨੂੰ ਆਪਣੇ ਘਰ ਦੇ ਵਿੱਚ ਜਾਂ ਆਪਣੇ ਖੇਤਾਂ ਦੇ ਵਿੱਚ ਜਿਹੜੇ ਪੌਦੇ ਆ ਉਹ ਫੁੱਲ ਦੇ ਉਗਾਉਣੇ ਪਸੰਦ ਹਨ ਅਤੇ ਜ਼ਿਆਦਾਤਰ ਮੈਨੂੰ ਫੁੱਲ ਦੇ ਜਾਂ ਕੋਈ ਸਬਜ਼ੀ ਲਾਉਣੀ ਪਸੰਦ ਹੈ ਸਬਜ਼ੀਆਂ ਦੇ ਵਿੱਚ ਆਪਾਂ ਕਿਸੇ ਵੀ ਪ੍ਰਕਾਰ ਜਿਵੇਂ ਕਿ ਆਪਾਂ ਪਿਆਜ ਦੀ ਗੱਲ ਕਰਾਂਗੇ ਗੋਭੀ ਦੀ ਗੱਲ ਕਰਾਂਗੇ ਜਾਂ ਬੈਂਗਣ ਦੇ ਬੂਟਿਆਂ ਦੀ ਗੱਲ ਕਰਾਂਗੇ ਜਾਂ ਆਪਾਂ ਮਿਰਚਾਂ ਦੇ ਬੂਟਿਆਂ ਦੀ ਗੱਲ ਕਰਾਂਗੇ ਆਲੂ ਵੀ ਮੈਨੂੰ ਬੀਜਣੇ ਬਹੁਤ ਪਸੰਦ ਹਨ ਅਤੇ ਪੌਦੇ ਗੁਲਾਬ ਦੇ ਫੁੱਲ ਮੈਨੂੰ ਬਹੁਤ ਪਸੰਦ ਹਨ ਆਲ਼ੇ ਦੁਆਲ਼ੇ ਮੈਨੂੰ ਆਪਣਾ ਫੁੱਲਾਂ ਦੇ ਨਾਲ ਹੀ ਘਿਰਾਵ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਫੁੱਲ ਲ ਉਗਾਉਣਾ ਬਹੁਤ ਪਸੰਦ ਕਰਦਾ ਹਾਂ